ਪੰਜਾਬ ਵਿੱਚ ਪ੍ਰਮੁੱਖ ਟੈਕਨੋਲਜੀ ਸੈਕਟਰ ਉਹ ਹਨ ਜੋ ਇੱਥੇ ਦੇ ਕਿੱਤਿਆਂ ਨਾਲ ਸੰਬੰਧ ਇੱਥੋਂ ਦੇ ਇਲਾਕਾਈ ਕਿੱਤਿਆ ਨਾਲ ਸੰਬੰਧਿਤ ਹਨ ਜਿਵੇਂ ਕਿ ਖੇਤੀਬਾੜੀ ਨਾਲ ਸੰਬੰਧਿਤ ਟੈਲੀਕੋਮ ਨਾਲ ਸੰਬੰਧਿਤ ਇਲੈਕਟਰੋਨਿਕਸ ਨਾਲ ਸੰਬੰਧ ਇਸ ਦਾ ਕਾਰਨ ਇਹ ਹੈ ਕਿ ਲੋਗ ਇਹਨਾਂ ਸਭ ਖਿੱਤਿਆਂ ਵਿੱਚ ਜ਼ਿਆਦਾ ਕੰਮ ਕਰਦੇ ਹਨ ਜਿਸ ਕਾਰਨ ਇਹਨਾਂ ਸਭ ਖਿੱਤਿਆਂ ਵਿੱਚ ਵਿਕਾਸ ਹੋਣ ਦੇ ਦਾ ਵਿਕਾਸ ਹੋਣਾ ਕਾਫੀ ਜ਼ਰੂਰੀ ਹੈ ਇਸ ਕਰਕੇ ਇਹਨਾਂ ਇਹਨਾਂ ਵੱਲ ਪੰਜਾਬ ਸਰਕਾਰ ਸਰਕਾਰ ਅਤੇ ਪੰਜਾਬ ਦੇ ਲੋਕਾਂ ਵੱਲੋਂ ਖਾਸ ਧਿਆਨ ਦਿੱਤਾ ਜਾਂਦਾ ਹੈ ਜਿਵੇਂ ਕਿ ਜੇਕਰ ਅਸੀਂ ਖੇਤੀਬਾੜੀ ਦੀ ਗੱਲ ਕਰੀਏ ਤਾਂ ਖੇਤੀਬਾੜੀ ਵਿੱਚ ਕਾਫੀ ਸਾਰੇ ਇਹੋ ਜਿਹੇ ਆਧੁਨਿਕ ਟੈਕਨੋਲਜੀ ਆ ਗਈ ਹੈ ਜਿਹੜੇ ਕਿ ਲੋਕਾਂ ਨੂੰ ਘੱਟ ਤੋਂ ਘੱਟ ਮਜ਼ਦੂਰਾਂ ਦੇ ਇਸਤੇਮਾਲ ਕਰਕੇ ਵੀ ਜਦ ਵੱਡੇ ਤੋਂ ਵੱਡੀ ਜਗ੍ਹਾ ਉੱਤੇ ਫਸਲ ਉਗਾਉਣ ਵਿੱਚ ਮਦਦ ਕਰਦੀ ਹੈ ਜਿਵੇਂ ਕੰਬਾਈਨ ਇਸ ਤੋਂ ਇਲਾਵਾ ਟੈਲੀਕੋਮ ਦੇ ਖੇਤਰ ਵਿੱਚ ਵੀ ਟੈਕਨੋਲਜੀ ਕਾਫੀ ਅੱਗੇ ਵੱਧ ਰਹੀ ਹੈ ਕਿਉਂਕੀ ਲੋਕ ਕਿਉਂਕੀ ਲੋਕਾਂ ਦਾ ਇੱਕ ਦੂਸਰੇ ਨਾਲ ਜ ਜਾਣਕਾਰੀ ਸਾਂਝੇ ਕਰਨਾ ਕਾਫੀ ਜ਼ਰੂਰੀ ਹੁੰਦਾ ਹੈ ਅਤੇ ਕਿਸੇ ਵੀ ਜਗ੍ਹਾ ਦੀ ਤਰੱਕੀ ਲਈ ਕਾਫੀ ਜ਼ਰੂਰੀ ਚੀਜ਼ ਹੈ ਧੰਨਵਾਦ